ਹੈਲੋ ਹਾਂਜੀ ਵੋਆਇਸ ਕੈਟਰਿੰਗ ਸਰਵਿਸ ਤੋਂ ਬੋਲਦੇ ਹਾਂਜੀ ਭਾਅ ਜੀ ਮੈਂ ਤੁਹਾਨੂੰ ਇਹ ਯਾਰ ਮੈਂ ਪੁੱਛਣਾ ਸੀ ਕਿ ਅਸੀਂ ਮੇਰੇ ਭਾਈ ਦੀ ਵੈਡਿੰਗ ਹੈ ਮੈਂ ਇੱਕ ਪੈਲਿਸ ਬੁੱਕ ਕਰਨਾ ਚਾਹੁੰਦਾ ਅੱਛਾ ਭਾਅ ਜੀ ਮੈਂ ਪੁੱਛਣਾ ਤਾ ਕਿ ਇਹ ਮਤਲਬ ਕਿ ਸਾਰਾ ਖਰਚਾ ਅਤੇ ਕਿੱਥੇ ਤੁਹਾਡਾ ਪੂਰਾ ਅੱਛਾ ਭਾਅ ਜੀ ਅੱਛਾ ਭਾਅ ਜੀ ਮੈਂ ਪੁੱਛ ਮੈਂ ਕਹਿ ਰਿਹਾ ਤਾ ਕਿ ਜਿੱਥੇ ਕਿ ਸਾਨੂੰ ਨਾ ਕਾਫੀ ਬੜੀ ਜਗ੍ਹਾ ਚਾਹੀਦੀ ਹੈ ਆਪਣੇ ਆਪਣੇ ਭਾਈ ਦੀ ਵੈਡਿੰਗ ਲਈ ਕਾਫੀ ਬੜੀ ਜਗ੍ਹਾ ਕਿ ਸਾਢੇ ਪੰਜ ਸੌ ਲੋਕ ਹਾਂ ਭਾਅ ਜੀ ਅਤੇ ਪੂਰਾ ਖਰਚਾ ਕਿੰਨਾਂ ਹੋਵੇਗਾ ਭਾਅ ਜੀ ਅੱਛਾ ਭਾਅ ਜੀ ਇੱਕ ਵਾਰ ਤੁਸੀਂ ਆ ਕੇ ਚੈੱਕ ਕਰ ਲਉ ਮੈਂ ਤੁਹਾਨੂੰ ਐਡਰੈੱਸ ਭੇਜ ਦੂੰਗਾ ਅਤੇ ਤੁਸੀਂ ਦੱਸ ਦਿਓ ਕਿ ਕਿਵੇਂ ਕਿਵੇਂ ਕੀ ਖਰਚਾ ਆਊਂਗਾ ਠੀਕ ਹੈ ਹਾਂਜੀ ਭਾਅ ਜੀ ਅਤੇ ਉਹ ਜਿਹੜਾ ਡੈਕੋਰੇਸ਼ਨ ਹੈ ਉਹ ਗ੍ਰੈਂਡ ਹੋਣਾ ਚਾਹੀਦਾ ਪੂਰਾ ਇੱਕਦਮ ਸਾਰਾ ਹੀ ਦੇਖਣੇ ਦੇਖਣ ਵਾਲੇ ਦੇਖ ਕੇ ਜਾਣ ਪੂਰੀ ਅੱਛਾ ਭਾਅ ਜੀ ਅਤੇ ਫੂਡ ਮੈਨੀਊ 'ਚ ਕੀ ਹੋਵੇਗਾ ਭਾਅ ਜੀ ਅੱਛਾ ਭਾਅ ਜੀ ਠੀਕ ਹੈ ਭਾਅ ਜੀ ਅਤੇ ਭਾਅ ਜੀ ਇੱਕ ਵਾਰ ਤੁਸੀਂ ਆ ਕੇ ਦੇਖ ਲਿਓ ਠੀਕ ਹੈ ਠੀਕ ਹੈ ਫਿਰ ਮੈਂ ਤੁਹਾਨੂੰ ਮੈਸੇਜ ਕਰ ਦੂੰਗਾ ਓਕੇ ਭਾਅ ਜੀ ਥੈਂਕ ਯੂ